ਹੈਲੋ ਓਲਾ ਐਪ ਤੋਂ ਗੱਲ ਕਰਦੇ ਹੋ ਮੈਂ ਹਰਲੀਨ ਕੌਰ ਗੱਲ ਕਰ ਰਹੀ ਆਂ ਚੰਡੀਗੜ੍ਹ ਤੋਂ ਤੇ ਮੈਂ ਤੁਹਾਡੇ ਤੋਂ ਕੈਬ ਬੁੱਕ ਕਰਵਾਉਣੀ ਆ ਮੇਰੇ ਜੋ ਮੰਮੀ ਪਾਪਾ ਨੇ ਉਹ ਅੰਮ੍ਰਿਤਸਰ ਘੁੰਮਣ ਗਏ ਹੋਏ ਨੇ ਤੇ ਹੁਣ ਉਹਨਾਂ ਨੇ ਆਪਦੇ ਜਿਲੇ ਵਾਪਿਸ ਆਉਣਾ ਬਠਿੰਡੇ ਤਾਂ ਮੈਂ ਤੁਹਾਡੇ ਤੋਂ ਉਹਨਾਂ ਦੇ ਯਾਤਰਾ ਲਈ ਕੈਬ ਬੁੱਕ ਕਰਵਾਉਣਾ ਚਾਹੁੰਦੀ ਆਂ ਤੇ ਮੈਨੂੰ ਪਲੀਜ਼ ਉਹਦਾ ਕੋਈ ਉਹਦਾ ਜਿੰਨਾ ਵੀ ਖਰਚਾ ਵਗੈਰਾ ਹੈਗਾ ਸਾਰਾ ਕੁਛ ਦੱਸ ਦੋ ਤੇ ਡਰਾਈਵਰ ਕਿਹੋ ਜਿਹੇ ਹੋਣਗੇ ਕਿਉਂਕਿ ਮੇਰੇ ਜਿਹੜੇ ਮੰਮੀ ਪਾਪਾ ਨੇ ਉਹ ਕਾਫੀ ਬਜ਼ੁਰਗ ਨੇ ਤੇ ਉਹਨਾਂ ਨੂੰ ਕਾਫੀ ਮਤਲਬ ਦੇਖਭਾਲ ਦੀ ਲੋੜ ਹੈ ਤਾਂ ਮੈਨੂੰ ਕੋਈ ਇਹੋ ਜਿਹਾ ਡਰਾਈਵਰ ਚਾਹੀਦਾ ਜੋ ਕਿ ਉਹਨਾਂ ਨੂੰ ਸਹੀ ਸਲਾਮਤ ਬਠਿੰਡੇ ਪਹੁੰਚਾ ਦਵੇ ਤੇ ਜਿਹੜਾ ਡਰਾਈਵਰ ਹੋਵੇ ਕੋਈ ਵੀ ਨਸ਼ਾ ਪੱਤਾ ਨਾ ਕਰਦਾ ਹੋਵੇ ਕਾਫੀ ਚੰਗਾ ਵਿਵਹਾਰ ਦਾ ਹੋਵੇ ਤੇ ਜਿੰਨੇ ਵੀ ਤੁਹਾਡੇ ਪੈਸੇ ਹੋਣਗੇ ਉਹ ਪਲੀਜ਼ ਤੁਸੀਂ ਮੈਨੂੰ ਦੱਸ ਦੋ ਤੇ ਮੈਂ ਤੁਹਾਡੀ ਪੇਮੈਂਟ ਕਰ ਦਵਾਂਗੀ ਤਾਂ ਮੈਨੂੰ ਸਾਰਾ ਕੁਝ ਟਾਈਮ ਤੁਸੀਂ ਭੇਜ ਸਕਦੇ ਹੋ ਵੀ ਕਿੰਨੇ ਵਜੇ ਕੈਬ ਆਵੇਗੀ ਉੱਥੇ ਤੇ ਕਦੋਂ ਕ ਤੱਕ ਉਹਨਾਂ ਨੂੰ ਪਹੁੰਚਾ ਦਵੇਗੀ ਉਹਨਾਂ ਦੇ ਬਠਿੰਡੇ ਜ਼ਿਲ੍ਹੇ ਵਿੱਚ ਤੇ ਬਾਕੀ